ਹੈਲੋ ਨਮਸਕਾਰ ਸਰ ਹਾਂਜੀ ਸਰ ਓਕੇ ਹਾਂਜੀ ਸਰ ਅੱਛਾ ਹਾਂਜੀ ਸਰ ਮੈਂ ਤੁਹਾਨੂੰ ਪੂਰਾ ਦੱਸ ਦਿੰਦੀ ਹਾਂ ਪਹਿਲਾਂ ਤੁਹਾਡਾ ਭਾਰਤੀਏ ਰੇਲਵੇ ਵਿੱਚ ਸਵਾਗਤ ਹੈ ਸਰ ਤੁਹਾਨੂੰ ਪਹਿਲੇ ਗੁਰਦਾਸਪੁਰ ਤੋਂ ਨਾ ਅੰਮ੍ਰਿਤਸਰ ਆਉਣਾ ਪੈਣਾ ਅੰਮ੍ਰਿਤਸਰ ਤੁਸੀਂ ਬਾਏ ਬੱਸ ਜਾਂ ਬਾਏ ਲੋਕਲ ਟ੍ਰੇਨ ਕੋਈ ਵੀ ਤੁਹਾਨੂੰ ਉੱਥੋਂ ਮਿਲਦੀ ਹੈ ਟਾਈਮ 'ਤੇ ਉਹ 'ਚ ਆ ਸਕਦੇ ਹੋ ਠੀਕ ਹੈ ਫਿਰ ਤੁਹਾਨੂੰ ਅੰਮ੍ਰਿਤਸਰ ਤੋਂ ਦਿੱਲੀ ਦੀ ਟ੍ਰੇਨ ਲੈਣੀ ਪੈਣੀ ਹੈ ਜਿਸਦਾ ਫੇਅਰ ਰੇਟ ਆ ਆਲਮੋਸਟ ਏਟ ਹੰਡਰਡ ਤੋਂ ਨਾਇਨ ਹੰਡਰਡ ਦੇ ਵਿੱਚ ਵਿੱਚ ਰਹੇਗਾ ਤੁਸੀਂ ਦਿੱਲੀ ਐਕਸਪ੍ਰੈਸ ਲੈ ਸਕਦੇ ਹੋ ਸ਼ਤਾਬਦੀ ਐਕਸਪਰੈਸ ਹੈ ਇਹ ਡੇਲੀ ਚਲਦੀਆਂ ਟਰੇਨ ਫਿਰ ਦਿੱਲੀ ਤੋਂ ਤੁਹਾਨੂੰ ਅੱਗੇ ਚੇਨਈ ਲਈ ਟ੍ਰੇਨ ਹੈ ਜਿਹੜੀ ਉਹ ਫਿਰ ਚੇਂਜ ਕਰਨੀ ਪੈਣੀ ਉਹ ਤੁਹਾਨੂੰ ਅੱਗੇ ਤੁਹਾਨੂੰ ਦੋ ਤੋਂ ਤਿੰਨ ਆਪਸ਼ਨਸ ਮਿਲ ਜਾਣਗੇ ਟਰੇਨ ਦੇ ਵਿੱਚ ਇੱਕ ਆ ਅੰਡਮਾਨ ਐਕਸਪਰੈਸ ਹੈ ਚੇਨਈ ਐਕਸਪਰੈਸ ਜਾਂਦੀ ਹੈ ਔਰ ਤਮਿਲਨਾਡੂ ਐਕਸਪਰੈਸ ਵੀ ਜਾਂਦੀ ਹੈ ਇੱਕ ਇਹ ਆਪਸ਼ਨਸ ਹੈ ਸਰ ਚੇਨਈ ਲਈ ਸਰ ਜਿਹੜੀ ਅੰਮ੍ਰਿਤਸਰ ਤੋਂ ਦਿੱਲੀ ਤੱਕ ਰਹੇਗੀ ਉਹ ਸਰ ਤੁਹਾਡਾ ਤੁਸੀਂ ਅੱਠ ਸੌ ਤੋਂ ਨੌ ਸੌ ਦੇ ਵਿੱਚ ਲੈ ਕੇ ਚੱਲੋ ਇੰਨਾ ਇਹਦਾ ਰਹੇਗਾ ਰੇਟ ਰਹੇਗਾ ਔਰ ਸਰ ਜਿਹੜੀ ਦਿੱਲੀ ਤੋਂ ਚੇਨਈ ਹੈ ਨਾ ਉਹ ਦੋ ਤੋਂ ਢਾਈ ਹਜ਼ਾਰ ਦੇ ਵਿੱਚ ਹੈ ਅਕੋਰਡਿੰਗ ਟੂ ਜੇ ਤੁਸੀਂ ਏ ਸੀ ਲੈਂਦੇ ਹੋ ਤਾਂ ਫਿਰ ਤਾਂ ਅਪਟੂ ਥ੍ਰੀ ਥਾਊਜੈਂਡ ਹੈ ਤਿੰਨ ਹਜ਼ਾਰ ਤੋਂ ਉੱਪਰ ਹੈ ਅਤੇ ਜੇ ਤੁਸੀਂ ਸਲਿਪਰ ਦਾ ਲੈਂਦੇ ਹੋ ਤਾਂ ਉਹ ਦੋ ਹਜ਼ਾਰ ਤੱਕ ਵੀ ਹੋ ਜਾਵੇਗਾ ਉਹਦੇ ਵਿੱਚ ਸਰ ਉਹੀ ਮੈਂ ਬੋਲਿਆ ਨਹੀਂ ਤਿੰਨ ਸਾਢੇ ਤਿੰਨ ਹਜ਼ਾਰ ਤੱਕ ਠੀਕ ਹੈ ਓਕੇ ਸਰ ਥੈਂਕ ਯੂ